ਚੋਕਲੇਟ ਹੇਜ਼ਲਨਟ ਰੋਲ ਪੇਸਟਰੀ ਮੱਖਣ ਦਾਲਚੀਨੀ 'ਤੇ ਇੱਕ ਚਿਕਨੀ ਪਰਤ ਹੁੰਦੀ ਹੈ ਹੇਜ਼ਲਨਟ ਬਰਾ ਬਨਾਵਟ 'ਤੇ ਜੋਰ ਦਿੱਤਾ ਜਾਂਦਾ ਹੈ ਇੱਕ ਛੋਟੇ ਕਟੋਰੇ ਵਿੱਚ ਦਾਲਚੀਨੀ ਚੀਨੀ ਨਮਕ ਨੂੰ ਮਿਲਾ ਕੇ ਚੋਕਲੇਟ ਹੇਜ਼ਲਨਟ ਦਾ ਉੱਪਰ ਚੀਨੀ ਦਾ ਮਿਸ਼ਰਨ ਛਿੜਕੋ ਸਿਰੇ ਤੋਂ ਆਟੇ ਨੂੰ ਰੋਲ ਕਰਨਾ ਸ਼ੁਰੂ ਕਰੋ ਜਦੋਂ ਤੱਕ ਲੰਬੀ ਤਰ੍ਹਾਂ ਰੋਲ ਨਾ ਬਣ ਜਾਵੇ ਆਟੇ ਦੇ ਸਿਰੇ ਨੂੰ ਲੰਬਾ ਕੱਟ ਲਵੋ ਰੋਲ ਅਲੱਗ ਅਲੱਗ ਮਾਫੀਨ ਟੀਨ ਦੇ ਵਿੱਚ ਰੱਖੋ ਉੱਪਰ ਤੋਂ ਹੇਜ਼ਲਨਟ ਛਿੜਕੋ ਅਠਾਈ ਤੋਂ ਪੈਂਤੀ ਮਿਨਟ ਤੱਕ ਬੇਕ ਕਰੋ ਜਦੋਂ ਤੱਕ ਬੁਲਬੁਲੇ ਨਾ ਉੱਠਣ ਜਾਂ ਬਰਾਉਨ ਹੋ ਜਾਵੇ ਉਦੋਂ ਤੱਕ ਪਕਾਓ ਅਤੇ ਗਰਮਾ ਗਰਮ ਪਰੋਸੋ ਬਦਾਮ ਕਾਜੂ ਮੂੰਗਫਲੀ ਹੇਜਲਨਟ ਤਰਬੂਜ ਦੇ ਬੀਜ ਸੂਰਜਮੁਖੀ ਦੇ ਬੀਜ ਕੱਦੂ ਦੇ ਬੀਜ ਇਹਨਾਂ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਈ ਮਿਨਰਲ ਫਾਈਬਰ ਹੁੰਦਾ ਹੈ ਸਰੀਰ ਨੂੰ ਐਨਰਜੀ ਦਿੰਦਾ ਹੈ ਕਮਜ਼ੋਰੀ ਦੂਰ ਕਰਦਾ ਹੈ ਸਵੇਰੇ ਭਿਓਂ ਕੇ ਬਦਾਮ ਅਖਰੋਟ ਖਾਣ ਦੇ ਨਾਲ ਚਿਹਰੇ 'ਤੇ ਚਮਕ ਆਉਂਦੀ ਹੈ ਹੱਡੀਆਂ ਮਜਬੂਤ ਹੁੰਦੀਆਂ ਹਨ ਸੀਮਿਤ ਮਾਤਰਾ ਵਿੱਚ ਖਾਣਾ ਚਾਹੀਦਾ ਹੈ ਇਹਦੇ ਨਾਲ ਵਜਨ ਵੀ ਵੱਧਦਾ ਹੈ ਡਾਈਕੁਏਰੀ ਇੱਕ ਕੋਕਟੇਲ ਹੈ ਇਹ ਨਿੰਬੂ ਦਾ ਰਸ ਚੀਨੀ ਜਾਂ ਕੁਛ ਹੋਰ ਮਿੱਠਾ ਹੁੰਦਾ ਹੈ ਇਹਨੂੰ ਚੋਕਲੇਟ ਛੇਕਰ ਦੇ ਵਿੱਚ ਰਲਾ ਕੇ ਤਿਆਰ ਕੀਤਾ ਜਾਂਦਾ ਹੈ ਇਹਦੇ ਚੀਨੀ ਮਿਲਾਓ ਉਪਰੋਂ ਬਰਫ ਪਾਓ ਅਤੇ ਹਿਲਾ ਦਿਓ ਅਤੇ ਗਿਲਾਸ ਵਿੱਚ ਛਾਣ ਲਓ ਇੱਦਾਂ ਇਹ ਤਿਆਰ ਹੋ ਜਾਂਦਾ ਹੈ